ਹੈਲੋ ਹਾਂਜੀ ਹਾਂਜੀ ਗੁਰਜੀਤ ਸਿੰਘ ਕੀ ਹਾਲ ਨੇ ਕੀ ਬਣਾਈ ਜਾਂਦੇ ਹੋ ਹੋਰ ਚਲੋ ਵਧੀਆ ਵਧੀਆ ਵੀਰ ਹੋਰ ਅੱਜ ਤਾਂ ਮੈਂ ਡਿਸਕਸ ਕਰਨੀ ਸੀ ਮੇਨ ਮੁੱਦੇ 'ਤੇ ਜਿਹੜੀ ਗਲੋਬਲ ਵਾਰਮਿੰਗ ਚੱਲ ਰਹੀ ਹੈ ਅੱਜ ਕੱਲ੍ਹ ਆਪਣੇ ਖੇਤੀ 'ਤੇ ਵੀ ਬੜਾ ਅਸਰ ਆ ਗਿਆ ਵੀਰ ਇਹਦਾ ਜਿਵੇਂ ਪਿਛਲੀ ਵਾਰ ਤੁਸੀਂ ਝਾੜ ਦਾ ਦੇਖਿਆ ਕਣਕ ਦਾ ਵੀ ਅਗੇਤੀ ਕਣਕ ਗਲੋਬਲ ਵਾਰਮਿੰਗ ਕਰਕੇ ਗਰਮੀ ਛੇਤੀ ਪੈਣ ਲੱਗ ਗਈ ਅਤੇ ਕਣਕਾਂ ਦੇ ਝਾੜ ਆਪਣੇ ਕਿੰਨੇ ਕਿੰਨੇ ਘੱਟ ਗਏ ਸੀਗੇ ਅਤੇ ਹਾਂ ਆਪਾਂ ਹੁਣ ਮੈਂ ਇਹੀ ਚਾਹੁੰਦਾ ਸੀ ਕਿ ਰਲ ਮਿਲ ਕੇ ਆਪਾਂ ਥੋੜ੍ਹਾ ਜਿਹਾ ਇਹ ਕਰੀਏ ਵੀ ਕਿਸਾਨਾਂ ਨੂੰ ਜਾਗਰੂਕ ਕਰੀਏ ਵੀ ਪਰਾਲੀ ਨੂੰ ਅੱਗ ਨਾ ਲਾਉਣ ਹਾਂ ਹਾਂ ਹਾਂ ਵੈਸੇ ਤਾਂ ਹੁਣ ਸਰਕਾਰ ਨੇ ਬੜੀਆਂ ਮਸ਼ੀਨਾਂ ਮਸ਼ੀਨਰੀ ਵੀ ਦਈ ਆ ਅਤੇ ਗੱਠਾਂ ਬਣਾਉਣ ਆਲੀ ਮਸ਼ੀਨਾਂ ਵੀ ਦੇਤੀਆਂ ਵੀ ਪਰਾਲੀ ਅੱਗ ਨਾ ਲਾਉਣ ਕਿਸਾਨ ਬਾਕੀ ਆਪਾਂ ਆਪਣੇ ਪੱਧਰ 'ਤੇ ਵੀ ਥੋੜ੍ਹਾ ਜਿਹਾ ਕਰੀਏ ਵੀ ਲੋਕਾਂ ਨੂੰ ਜਾਗਰਤ ਕਰੀਏ ਵੀ ਗਲੋਬਲ ਵਾਰਮਿੰਗ ਬਾਰੇ ਦੱਸੀਏ ਥੋੜ੍ਹਾ ਸਾਰਾ ਵੀ ਇਹਦੇ ਕੀ ਅਸਰ ਨੇ ਹੈ ਨਾ ਅਤੇ ਪਿੰਡ ਪਿੰਡ 'ਚ ਹਾਂ ਜਿਵੇਂ ਹਾਂ ਇੰਡਸਟਰੀ ਵੀ ਵਾ ਕਰ ਰਹੀ ਹੈ ਇਫੈਕਟ ਹੋ ਰਹੇ ਨੇ ਇੰਡਸਟਰੀ ਦੇ ਵੀ ਬਾਕੀ ਆਹ ਜਿਹੜੀ ਵਾਰ ਗੱਲ ਕਰਦੇ ਸੀ ਆਪਾਂ ਵੀ ਲੱਗੀ ਹੋਈ ਆ ਹੈ ਨਾ ਉਹਦੇ ਵੀ ਅਸਰ ਨੇ ਹਾਂ ਹਾਂ ਪਰ ਆਪਾਂ ਕੋਸ਼ਿਸ਼ਾਂ ਕਰੀਏ ਆਪਣੇ ਵੱਲੋਂ ਵੀ ਕਿਸਾਨੀ ਦੋ ਸੰਦੇਸ਼ ਦੇਈਏ ਵੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਜਿਹਦੇ ਕਰਕੇ ਵੀ ਆਪਣਾ ਅਤੇ ਹਾਂ ਹਾਂ ਮੇਨ ਤਾਂ ਉਹੀ ਆ ਵੀ ਪਰਾਲੀ ਦਾ ਫ਼ਿਰ ਇਕ ਲਖਤ ਜ਼ਿਆਦਾ ਉਹ ਲੱਗਦੀ ਹੈ ਨਾ ਅੱਗ ਸਾਰੇ ਬਾਕੀ ਤਾਂ ਲੋਕ ਜਾਗਰੂਕ ਹੋ ਰਹੇ ਨੇ ਹੌਲੀ ਹੌਲੀ ਸਰਕਾਰ ਵੀ ਉਹ ਕਰ ਰਹੀ ਆ ਅਤੇ ਆਪਾਂ ਆਪਣੇ ਵੱਲੋਂ ਵੀ ਕੋਸ਼ਿਸ਼ਾਂ ਕਰੀਏ ਵੈਸੇ ਤਾਂ ਮਸ਼ੀਨਾਂ ਸਰਕਾਰ ਨੇ ਬੜੀਆਂ ਦੇ ਦਿੱਤੀਆਂ ਇਸ ਵਾਰ ਸਬ ਸਬਸੀਡੀਆਂ ਵੀ ਕਾਫੀ ਦੇਤੀ ਸਰਕਾਰ ਨੇ ਮਸ਼ੀਨਾਂ 'ਤੇ ਅਤੇ ਇਸ ਮੁੱਦੇ 'ਤੇ ਆਪਾਂ ਕਦੇ ਬੈਠ ਕੇ ਗੱਲਬਾਤ ਕਰੀਏ ਅਤੇ ਪਿੰਡ ਪੱਧਰ 'ਤੇ ਥੋੜ੍ਹੇ ਛੋਟੇ ਛੋਟੇ ਪ੍ਰੋਗਰਾਮ ਰੱਖੀਏ ਚਲੋ ਫਿਰ ਮਿਲ ਕੇ ਕਰਦੇ ਹਾਂ ਆਪਾਂ ਠੀਕ ਆ ਜੀ ਠੀਕ ਆ ਗੁਰਦੀਪ ਸਿੰਘ ਜੀ ਠੀਕ ਆ